ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ ਗੱਲ ਸੁਣੋ ਅਸੀਂ ਪੰਜਾਬ ਦੇ ਵਿੱਚ ਰਹਿਣ ਵਾਲੇ ਆਂ ਸਾਡੇ ਚਾਰ ਖੇਤਰ ਹੈ ਮਾਲਵਾ ਹੈ ਦੁਆਬਾ ਹੈ ਮਾਝਾ ਹੈ ਤੇ ਇਕ ਕਿਹੜਾ ਐ ਹੈਗੇ ਆ ਤੇ ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਵੱਖ ਵੱਖ ਹੀ ਇਹਨਾਂ ਦੀਆਂ ਸਾਰੀਆਂ ਵੀ ਕੰਮ ਕੀਤੇ ਜਾਂਦੇ ਹਨ ਜਿੱਦਾਂ ਕਿ ਆਪਾਂ ਮਾਝੇ ਦੇ ਉੱਤੇ ਰਹਿਣ ਵਾਲੇ ਹਨ ਇਹ ਸਾਡਾ ਜਟਕਾ ਮਾਝਾ ਹੈਗਾ ਆ ਜਿਵੇਂ ਕਿ ਅੰਬਰਸਰ ਵੱਲ ਐ ਇਧਰਲੇ ਸ਼ਹਿਰਾਂ ਦੇ ਵਿੱਚ ਸਾਡੇ ਸਾਰੀ ਮਾਝੇ ਦੀ ਬੋਲੀ ਵੱਖਰੀ ਹੁੰਦੀ ਹੈ ਤੇ ਜਿਹੜੇ ਆਪਾਂ ਰਹਿੰਨੇ ਜਿੱਦਾਂ ਆਪਾਂ ਇਧਰ ਮਾਲਵੇ ਦੇ ਵਿੱਚ ਰਹੀਦਾ ਵਾ ਮਾਲਵੇ ਦੇ ਵਿੱਚ ਸ਼ਹਿਰੀ ਲੋਕ ਇਹਨਾਂ ਦੀ ਇੰਡਸਟਰੀ ਏਰੀਆ ਵਗੈਰਾ ਇਹਨਾਂ ਦੀ ਬੋਲੀ ਦਾ ਬਹੁਤ ਫਰਕ ਹੈ ਇਹਨਾਂ ਵੱਖ ਵੱਖ ਆਪਣੀਆਂ ਆਪਣੀਆਂ ਬੋਲੀਆਂ ਹੁੰਦੀਆਂ ਹਨ ਤੇ ਆਪਣੇ ਰਹਿਣ ਦਾ ਸਹਿਣ ਦਾ ਵੀ ਇਹਨਾਂ ਦਾ ਵੱਖ ਵੱਖ ਹੀ ਥੋੜਾ ਹੀ ਢੰਗ ਹੀ ਹੁੰਦਾ ਹੈ ਤੇ ਇਸ ਕਰਕੇ ਅਸੀਂ ਇਹਨਾਂ ਬੋਲੀਆਂ ਦੇ ਵਿੱਚ ਇਹਨਾਂ ਖੇਤਰਾਂ ਨੂੰ ਆਪਣੇ ਨਾਲ ਲਾਣ ਦੇ ਲਈ ਇੱਕ ਦੂਜੇ ਦੇ ਨਾਲ ਬਰਾਬਰੀ ਦਾ ਹੁ ਦਿੰਦੇ ਆਗੇ ਤੇ ਨੰਬਰ ਦੋ ਤਾਂ ਆਪਾਂ ਜਿੱਦਾਂ ਮਾਲਵੇ ਦੇ ਵਿੱਚ ਇੰਡਸਟਰੀ ਏਰੀਆ ਸਾਰਾ ਲੋਕ ਵੀ ਬਹੁਤ ਰਿਚ ਵਗੈਰਾ ਹੈਗੇ ਆ ਕਿਉਂਕਿ ਇਹਨਾਂ ਨੇ ਇੰਡਸਟਰੀਆਂ ਵਗੈਰਾ ਲਗਾਈਆਂ ਗਈਆਂ ਤੇ ਇਹਨਾਂ ਦੇ ਵੀ ਰਿਚ ਹੈਗੇ ਆ ਮੈਂਬਰ ਤੇ ਜਿਹੜੇ ਐਧਰ ਹੈਗੇ ਐ ਦੁਆਬੇ ਦੇ ਵਿੱਚ ਦੁਆਬੇ ਦੇ ਵਿੱਚ ਸਾਰਾ ਪਹਾੜੀ ਇਲਾਕਾ ਹੈ ਇਧਰ ਦੇ ਸਾਰੇ ਲੋਕਾਂ ਦੀਆਂ ਪਹਾੜਾਂ ਦੇ ਵਿੱਚ ਆਪਣੀ ਆਪਣੀ ਇੰਡਸਟਰੀਆਂ ਸੋੜੇ ਖੁੱਲੇ ਮਾਹੌਲ ਦੇ ਵਿੱਚ ਰਹਿਣ ਵਿੱਚ ਦਿੰਦੇ ਆ ਜੋ ਮਾਲਵਾ ਜੱਟ ਕਾਲਾ ਕਾ ਮਾਝਾ ਹੁੰਦਾ ਹੈ ਜਇਹਦੇ ਨਾਲ ਆਪਣਾ ਖੇਤੀਬਾੜੀ ਦਾ ਕੰਮ ਕਰਦੇ ਹਨ ਤੇ ਖੁੱਲੇ ਹਵਾ ਹਾਰ ਦੇ ਵਿੱਚ ਰਹਿੰਦੇ ਹਨ ਅਤੇ ਬਾਹਰ ਦੂਰ ਦੂਰ ਤੱਕ ਇਹਨਾਂ ਨੇ ਆਪਣੇ ਖਰੀਦੇ ਜਗ੍ਹਾ ਖਰੀਦੀਆਂ ਹੁੰਦੀਆਂ ਖੁੱਲਾ ਵਾਤਾਵਰਨ ਹੁੰਦਾ ਹੈ ਮਾਝੇ ਦੇ ਵਿੱਚ ਤੇ ਆਪਣਾ ਹੀ ਘਰ ਦਾ ਸਾਰਾ ਜਿੰਮੀਦਾਰਾਂ ਕਰਕੇ ਰੋਟੀ ਪਾਣੀ ਦਾ ਅੱਛਾ ਗੁਜ਼ਾਰਾ ਚਲਾਂਦੇ ਹਨ ਤੇ ਇਹ ਨੰਬਰ ਤਿੰਨ ਤੇ ਉਹ